ਸਤਿ ਸ਼੍ਰੀ ਅਕਾਲ ਜੀ ਜਿਹੜਾ ਭੰਗੜਾ ਹੈਗਾ ਉਹ ਆਪਣਾ ਪੰਜਾਬ ਦਾ ਪ੍ਰਸਿੱਧ ਉਹ ਭੰਗੜੇ ਨੂੰ ਮੰਨਿਆ ਜਾਂਦਾ ਲੋਕ ਨਾਚ ਹੈ ਇਸ ਕਰਕੇ ਜਿਹੜਾ ਭੰਗੜੇ ਦਾ ਹੈਗਾ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜਾ ਭੰਗੜੇ ਦਾ ਕੰਮ ਹੈ ਉਹ ਯਾਣੀ ਕਿ ਮੈਂ ਸ਼ੁਰੂ ਤੋਂ ਹੀ ਭੰਗੜੇ ਦੀ ਕੋਚ ਰਹੀ ਆ ਭਲਾ ਕਲਾਸ ਪਹਿਲਾਂ ਮੈਂ ਛੋਟੀ ਸੀ ਉਸ ਤੋਂ ਓਦੋਂ ਮੈਂ ਆਪ ਖੁਦ ਸਕੂਲਾਂ 'ਚ ਕਰਦੀ ਰਹੀ ਹਾਂ ਪਹਿਲੇ ਛੋਟਿਆਂ ਤੋਂ ਹੀ ਮਤਲਬ ਉਸ ਤੋਂ ਬਾਅਦ ਹੁਣ ਫਿਰ ਜਦੋਂ ਵਿਆਹ ਹੋੋ ਗਿਆ ਮੇਰੀਆਂ ਦੋੋ ਬੇਟੀਆਂ ਨੇ ਉਹ ਕਰਦੀਆਂ ਰਹਿੰਦੀਆਂ ਇੱਕ ਬੇਟਾ ਮੇਰਾ ਯਾਨੀ ਕਿ ਉਹਨਾਂ ਨੇ ਵੀ ਹੁਣ ਸ਼ੁਰੂ ਤੋਂ ਹੀ ਮੈਂ ਉਹਨਾਂ ਨੂੰ ਯਾਨੀ ਕਿ ਪਾਰਟੀਸਪੇਟ ਕਰਾਉਣਾ ਪਸੰਦ ਕਰਦੀ ਆ ਕਿ ਸਕੂਲਾਂ 'ਚ ਵੀ ਕਰਦੀਆਂ ਰਹੀਆਂ ਹੁਣ ਕਾਲਜ 'ਚ ਵੀ ਹੁਣ ਇਸ ਟਾਈਮ ਯਾਨੀ ਕਿ ਮੇਰਾ ਜਿਹੜਾ ਬੇਟਾ ਉਹ ਕਰਦਾ ਉਹਨੂੰ ਮੈਂ ਅਕੈਡਮੀ 'ਚ ਲਾਇਆ ਹੋਇਆ ਭੰਗੜੇ ਨੂੰ ਪੂਰਾ ਐਕਸਪਰਟ ਬਣਾਉਣ ਵਾਸਤੇ ਅਤੇ ਉਸ ਤੋਂ ਜਿਹੜੇ ਤੁਸੀਂ ਮੈਨੂੰ ਹੁਣ ਪੁੱਛਿਆ ਕਿ ਮੈਂ ਉਹਨਾਂ ਦੇ ਪਹਿਰਾਵਾ ਪਹਿਰਾਵਾ ਜਿਹੜਾ ਉਹ ਜਿਹੜੇ ਮੁੰਡੇ ਆ ਉਹ ਯਾਨੀ ਕਿ ਜਿਹੜਾ ਧੋਤੀ ਕੁੜਤਾ ਯਾਨੀ ਕਿ ਜਿਹੜੀ ਪੱਗ ਆ ਪੱਗ ਨੂੰ ਯਾਨੀ ਕਿ ਆਪਾਂ ਜਿਹੜਾ ਤੁਰਲੇ ਵਾਲੀ ਬਣਾ ਲੈਂਦੇ ਹਾਂ ਅੱਗੋਂ ਅੱਗੋਂ ਯਾਨੀ ਕਿ ਬਾਰਾਂ ਪੰਦਰਾਂ ਇੰਚ ਜਾਂ ਤੱਕ ਯਾਨੀ ਕਿ ਉਹਨੂੰ ਮਾਵਾ ਦਿੱਤਾ ਜਾਂਦਾ ਠੀਕ ਹੈ ਜਿਹੜਾ ਹੈਗਾ ਧੋਤੀ ਹੈ ਧੋਤੀ ਨੂੰ ਯਾਨੀ ਕਿ ਜੇ ਆਪਾਂ ਸਟਿਚਿੰਗ ਜਿਹੜਾ ਆਪਾਂ ਵੱਡਾ ਬੰ ਮੁੰਡਾ ਜਾਂ ਕੁੜੀ ਆ ਉਹ ਆਪਾਂ ਯਾਨੀ ਕਿ ਧੋਤੀ ਨੂੰ ਹੋ ਗਏ ਬੰਨ ਲਾਂਗੇ ਸਾਟਣ ਦੇ ਕੱਪੜੇ ਨਾਲ ਤਿਆਰ ਕੀਤੀ ਜਾਂਦਾ ਉਹ ਅਲੱਗ ਅਲੱਗ ਸ਼ਾਈਨ ਵਾਲੀ ਜੋ ਮਰਜੀ ਹੈ ਯਾਨੀ ਕਿ ਸ਼ਾਈਨ ਵਾਲੇ ਹੁੰਦੇ ਆ ਇਹ ਕੱਪੜੇ ਭੰਗੜੇ ਵਾਲੇ ਅਤੇ ਜਿਹੜਾ ਉਹਨਾਂ ਦਾ ਕੁੜਤਾ ਮੈਂ ਆਪਣੇ ਬੱਚੇ ਦੀ ਡਰੈਸ ਜਿਹੜੀ ਬਣਾਈ ਸੀ ਖੁਦ ਬਣਾਈ ਸੀ ਮਤਲਬ ਜਿਹੜੀ ਉਹ ਜਿਹੜਾ ਉਹਨਾਂ ਦਾ ਕੁੜਤਾ ਸੀਗਾ ਉਹਦੇ 'ਤੇ ਮੈਂ ਟਿੱਕੀਆਂ ਲਾ ਕੇ ਅਤੇ ਗੋਟਾ ਲਾ ਕੇ ਤਿਆਰ ਕੀਤਾ ਸੀ ਕੁੜਤੇ ਵਾਲਾ ਗਲੇ ਵੈਨ ਵਾਲਾ ਗਲਾ ਬਣਾਇਆ ਸੀ ਅਤੇ ਨਾਲ ਦੀ ਪੱਗ ਉਹਦੇ ਜਿਹੜੀ ਜਿਹੜੀ ਜੁੱਤੀ ਹੈ ਪੰਜਾਬੀ ਜੁੱਤੀ ਹੁੰਦੀ ਹੈ ਜਿਹੜੇ ਫੁੰਮਣ ਆ ਫੁੰਮਣ ਦੋ ਹੱਥਾਂ 'ਤੇ ਬੰਨੇ ਜਾਂਦੇ ਨੇ ਅਤੇ ਦੋ ਹੀ ਪੈਰਾਂ 'ਚ ਵੀ ਬੰਨ ਸਕਦੇ ਹਾਂ ਮਤਲਬ ਬੰਨ ਸਕਦੇ ਹਾਂ ਮਤਲਬ ਜਿਹੜਾ ਹੱਥਾਂ ਵਾਲਾ ਉਹ ਹੱਥਾਂ 'ਤੇ ਜ਼ਰੂਰੀ ਇੱਕ ਕੰਠਾ ਪਾਇਆ ਜਾਂਦਾ ਕੰਠਾ ਇੱਕ ਕੁੰਡਲ ਪਾਇਆ ਜਾਂਦਾ ਜਿਹੜੇ ਮੁੰਡੇ ਆ ਉਹ ਵਾਲਾ ਜਿਹਾ ਪਾਉਂਦੇ ਆ ਮਤਲਬ ਰਬੜ ਦਾ ਹੁੰਦਾ ਜੋ ਵੀ ਉਹ ਪਾਉਂਦੇ ਆ ਅਤੇ ਜਿਹੜੀਆਂ ਕੁੜੀਆਂ ਯਾਨੀ ਕਿ ਉਹ ਭੰਗੜਾ ਪਾਉਣ ਵਾਸਤੇ ਸੂਟ ਦੀ ਵਰਤੋਂ ਵੀ ਕਰ ਲੈਂਦੀਆਂ ਪੰਜਾਬੀ ਸੂਟ ਦੀ ਟਿੱਕਾ ਹੋਇਆ ਝੁਮਕੇ ਹੋਏ ਆਹ ਹੁੰਦੇ ਫੁੰਮਣਾਂ ਵਾਲੇ ਹੈ ਨਾ ਅਤੇ ਉਸ ਜਿਹੜੀ ਉਹ ਜਿਹੜੀ ਚੁੰਨੀ ਆ ਉਹ ਚੁੰਨੀ 'ਤੇ ਕਿਨਾਰੀ ਵਾਲੀ ਗੋਟੀ ਲਾ ਗੋਟਾ ਲੈਂਦੀਆਂ ਕੁੜੀਆਂ ਅਤੇ ਕੁੜੀਆਂ ਅੱਜ ਕੱਲ੍ਹ ਵੈਸੇ ਧੋਤੀ ਵੀ ਪਾ ਲੈਂਦੀਆਂ ਧੋਤੀ ਕੁੜਤਾ ਕੁੜਤਾ ਮਤਲਬ ਲੋਂਗ ਹੁੰਦਾ ਉਹਨਾਂ ਦਾ ਚਿੱਟਾ ਹੁੰਦਾ ਜ਼ਿਆਦਾਤਰ ਚਿੱਟਾ ਸ ਬਣਾਇਆ ਜਾਂਦਾ ਧੋਤੀ ਜਿਹੜੇ ਮਰਜੀ ਰੰਗ ਦੀ ਉਹ ਵੀ ਕਰ ਲੈਂਦੀਆਂ ਜੁੱਤੀ ਪਾ ਲੈਂਦੀਆਂ ਹੈ ਨਾ ਹੈ ਨਾ ਅਤੇ ਮਤਲਬ ਭੰਗੜਾ ਬਹੁਤ ਜ਼ਿਆਦਾ ਵਧੀਆ ਮਤਲਬ ਹੋਰ ਆਪਾਂ ਮੰਨਦੇ ਹਾਂ ਸਾਰੇ ਤਰ੍ਹਾਂ ਦੀ ਜਿਹੜੀ ਪਰ ਭਾਸ਼ਾ ਹੈਗੀ ਆ ਉਹ ਵਧੀਆ ਹੁੰਦੀਆਂ ਨੇ ਪਰ ਜਿਹੜਾ ਪੰਜਾਬੀ ਭੰਗੜਾ ਉਹਦੇ 'ਚ ਮਜ਼ਾ ਹੀ ਕੁਛ ਹੋਰ ਹੁੰਦਾ ਤਾਂ ਜਦੋਂ ਆਪਾਂ ਅੱਜ ਕੱਲ ਇਹ ਵਿਆਹਾਂ ਸ਼ਾਦੀਆਂ 'ਤੇ ਵੀ ਯਾਨੀ ਕਿ ਭੰਗੜੇ ਹੀ ਪਾਏ ਜਾਂਦੇ ਹੈ ਪੰਜਾਬੀ ਲੋਕ ਨਾਚ ਹੀ ਕੀਤੇ ਜਾਂਦੇ ਨੇ ਜਿਵੇਂ ਕਿ ਦੁਨੀਆ ਵੀ ਬੜੀ ਖੁਸ਼ ਹੁੰਦੀ ਹੈ ਜੁਆਇਨ ਫੈਮਲੀਆਂ 'ਚ ਬੈਠੇ ਹੁੰਦੇ ਆ ਭੰਗੜਾ ਨੂੰ ਵੇਖਣ ਲੱਗੇ ਸਾਰੇ ਵਧੀਆ ਵਧੀਆ ਵੀ ਲੱਗਦਾ ਵਧੀਆ ਵੀ ਲੱਗਦਾ ਅਤੇ ਉਂਝ ਵੀ ਯਾਨੀ ਕਿ ਸਹੀ ਆ ਮਤਲਬ ਵਧੀਆ ਹੱ ਸਾਰਿਆਂ ਨਾਲੋਂ ਜ਼ਿਆਦਾ ਮੈਂ ਭੰਗੜੇ ਨੂੰ ਹੀ ਪਸੰਦ ਕਰਦੀ ਹਾਂ ਭੰਗੜੇ ਨੂੰ ਹੀ ਪਸੰਦ ਕਰਦੀ ਹਾਂ ਕਿ ਮੇਰੇ ਬੱਚੇ ਵੀ ਅੱਗੇ ਆਪਣੀਆਂ ਅਕੈਡਮੀਆਂ ਖੋਲ੍ਹਣ ਮੈਨੂੰ ਸ਼ੌਕ ਹੈ ਮੈਂ ਕ ਅਕੈਡਮੀ ਨ ਖੋਲ੍ਹੀ ਸੀ ਮੈਂ ਉਹਨਾਂ ਨੂੰ ਘਰੋਂ ਹੀ ਸਿਖਾਇਆ ਸੀ ਹੁਣ ਥਾਂ ਥਾਂ 'ਤੇ ਅਕੈਡਮੀਆਂ ਵੀ ਹੈ ਸਕੂਲਾਂ 'ਚ ਵੀ ਬੱਚੇ ਮੇਰਾ ਬੇਟਾ ਜਿਹੜਾ ਉਹ ਪਾਰਟੀਸਪੇਟ ਕਰਦਾ ਮੇਰੀਆਂ ਕੁੜੀਆਂ ਵੀ ਕਰਦੀਆਂ ਰਹੀਆਂ ਇਸ ਕਰਕੇ ਮੈਂ ਉਹਨਾਂ ਨੂੰ ਯਾਨੀ ਕਿ ਭੰਗੜੇ 'ਚ ਹੀ ਅੱਗੇ ਲਿਜਾਉਣਾ ਪਸੰਦ ਕਰਦੀ ਹਾਂ ਅਤੇ ਜਿਹੜੀਆਂ ਹੁਣ ਜਿਵੇਂ ਹੁਣ ਮੇਰੀ ਜਿਵੇਂ ਆਪਣੇ ਬਾਹਰ ਵੀ ਆਪਣੇ ਪ੍ਰ ਪ੍ਰਦੇਸ਼ਾਂ 'ਚ ਵੀ ਦੁਨੀਆ ਬੈਠੀ ਆ ਇੰਨੀ ਹੈ ਨਾ ਅਤੇ ਉੱਥੇ ਜਿਹੜੇ ਬੰਦੇ ਜਿਵੇਂ ਹੁਣ ਬੱ ਬੱਚੇ ਇੱਥੇ ਐਕਸਪਰਟ ਸੀ ਉਹਨਾਂ ਨੇ ਅਗਾਂਹ ਜਾ ਕੇ ਯਾਨੀ ਕਿ ਉਹ ਵੀ ਐਕਸਪਰਟ ਆਪਣੇ ਆਪ 'ਚ ਬ ਬਣ ਗਏ ਆ ਉਹਦੇ ਕਰਕੇ ਉਹਨਾਂ ਨੇ ਉੱਥੇ ਵੀ ਜਾ ਕੇ ਆਪਣਾ ਕੰਮ ਇਹ ਬਿਜਨਸ ਸ਼ੁਰੂ ਕਰ ਲਏ ਆ ਵਧੀਆ ਸਗੋਂ ਇਹ ਆਪਣੇ ਇੱਕ ਕਲਾ ਕਲਾ ਜਿੰਨੀ ਹੋ ਸਕੇ ਯਾਨੀ ਕਿ ਕਲਾ ਵਧੀਆ ਹੈਗੀ ਆ ਮਤਲਬ ਆਪਣਾ ਕਰ ਲਓ ਜਿੰਨਾ ਵਧੀਆ ਇਹ ਭੰਗੜਾ 'ਚ ਐਕਸਪਰਟ ਗਿੱਧੇ 'ਚ ਐਕਸਪਰਟ ਮਤਲਬ ਇਹ ਪੰਜਾਬੀ ਲੋਕ ਨਾਚ ਹੈ ਇਹਦੇ 'ਚ ਕੋਈ ਨੰਗਨ ਨਹੀਂ ਹੁੰਦਾ ਮਤਲਬ ਆਪਣਾ ਵਧੀਆ ਡਰੈਸ ਵੀ ਵਧੀਆ ਹੁੰਦੀਆਂ ਨੇ ਮਤਲਬ ਕੱਪੜੇ ਪ੍ਰੋਪਰ ਵ ਮਤਲਬ ਵਧੀਆ ਪਾਏ ਹੁੰਦੇ ਨੇ ਢੱਕਿਆ ਹੁੰਦਾ ਆਪਣੇ ਆਪ ਨੂੰ ਵਧੀਆ ਦੁਨੀਆ ਨੂੰ ਵੀ ਦੇਖਣ ਨੂੰ ਵੀ ਵਧੀਆ ਲੱਗਦਾ ਇਹਦੇ ਵਿੱਚ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ